ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਣੀਆ ਹੈ ਪੰਜ ਸਟੇਟਾਂ ਇੰਡੀਆ ਦੀ ਜੋ ਮੈਨੂੰ ਚੇਤਾ ਹੈ ਉਹ ਇਸ ਪ੍ਰਕਾਰ ਹਨ ਪਹਿਲੀ ਦਾ ਨਾਂ ਆਂਧਰ ਪ੍ਰਦੇਸ਼ ਦੂਜੀ ਸਟੇਟ ਇੰਡੀਆ ਦੀ ਮੱਧਿਆ ਪ੍ਰਦੇਸ਼ ਤੀਜੀ ਸਟੇਟ ਜੋ ਕਿ ਇੰਡੀਆ ਦੀ ਹੈ ਉਹ ਹੈ ਬਿਹਾਰ ਚੌਥੀ ਦੀ ਗੱਲ ਕਰਾਂ ਤਾਂ ਗੋਆ ਆਖਰੀ ਜੋ ਕਿ ਪੰਜਵੀਂ ਹੈ ਉਹ ਹੈ ਕਰਨਾਟਕਾ ਧੰਨਵਾਦ